ਹਾਂਜੀ ਮੇਰੇ ਘਰ ਦੇ ਕੋਲ ਤਾਂ ਕੋਈ ਲਾਇਬ੍ਰੇਰੀ ਨਹੀਂ ਹੈ ਹਾਂ ਥੋੜ੍ਹੀ ਜਿਹੀ ਇੱਥੋਂ ਚਾਰ ਪੰਜ ਕਿਲੋਮੀਟਰ ਦੇ ਕਰੀਬ ਲਾਈਬ੍ਰੇਰੀ ਹੈ ਅਤੇ ਜਦੋਂ ਅਸੀਂ ਕੁਝ ਸਿੱਖਣਾ ਹੋਵੇ ਤਾਂ ਉਹਦੇ ਵਾਸਤੇ ਸਾਨੂੰ ਉੱਥੋਂ ਤੱਕ ਪਹੁੰਚਣਾ ਵੀ ਪੈਂਦਾ ਹੈ ਕਿਉਂਕਿ ਮੈਨੂੰ ਪੜ੍ਹਨ ਦਾ ਸ਼ੌਕ ਵੀ ਹੈ ਅਤੇ ਮੈਂ ਇਸੇ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਆਪਣੇ ਘਰ ਤੋਂ ਲਾਈਬ੍ਰੇਰੀ ਦੇ ਵਿੱਚ ਜਾਂਦੀ ਹਾਂ ਅਤੇ ਉੱਥੇ ਮੈਨੂੰ ਕਈ ਕਿਸਮ ਦੀਆਂ ਕਿਤਾਬਾਂ ਉੱਥੇ ਮੈਨੂੰ ਮਿਲਦੀਆਂ ਹਨ ਜਿਹਦੇ ਵਿੱਚ ਉਹ ਸਾਹਿਤਕ ਕਿਤਾਬਾਂ ਵੀ ਹਨ ਗੁਰਬਾਣੀ ਦੀਆਂ ਵੀ ਕਿਤਾਬਾਂ ਹਨ ਪਰ ਮੈਨੂੰ ਸਾਰੀਆਂ ਕਿਤਾਬਾਂ ਦੇ ਵਿੱਚੋਂ ਗੁਰਬਾਣੀ ਦੀਆਂ ਕਿਤਾਬਾਂ ਪੜ੍ਹਨੀਆਂ ਬੜੀਆਂ ਚੰਗੀਆਂ ਲੱਗਦੀਆਂ ਹਨ ਇਹਦੇ ਵਿੱਚ ਇਹ ਹੈ ਕਿ ਸਾਨੂੰ ਇਹ ਸਮਝ ਲੱਗਦੀ ਹੈ ਗੁਰਬਾਣੀ ਨੂੰ ਪੜ੍ਹਦੇ ਵਕਤ ਕਿ ਅਸੀਂ ਮਨੁੱਖ ਦਾ ਜੇ ਜਨਮ ਹੋਇਆ ਹੈ ਤਾਂ ਕਿਸ ਲਈ ਹੋਇਆ ਹੈ ਅਤੇ ਇਸੇ ਕੁਸ਼ ਪ੍ਰਸ਼ਨ ਨੂੰ ਮੈਂ ਲੈ ਕੇ ਇਨ੍ਹਾਂ ਕਿਤਾਬਾਂ ਦੇ ਵਿੱਚੋਂ ਕੁਛ ਲੱਭਣ ਦਾ ਕੁਛ ਪੜ੍ਹਨ ਦਾ ਯਤਨ ਕਰਦੀ ਹਾਂ ਅਤੇ ਨਾਲ ਹੀ ਮੈਨੂੰ ਜੋ ਪੜ੍ਹਨ ਦਾ ਸ਼ੌਂਕ ਹੈ ਉਹ ਵੀ ਪੂਰਾ ਹੋ ਰਿਹਾ ਹੈ